ਹਾਂਜੀ ਹਾਂਜੀ ਹਾਂਜੀ ਆਜਾਗੇ ਕਿੰਨੇ ਵਜੇ ਠੀਕ ਹੈ ਜੀ ਠੀਕ ਐ ਜੀ ਠੀਕ ਹੈ ਜੀ ਤੇ ਜੀ ਮੈਨੂੰ ਛੁੱਟੀ ਦੇ ਦੋਗੇ ਥੋੜੀ ਦੇਰ ਵਾਸਤੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਪਹਿਲਾਂ ਸਵੇਰੇ ਬ੍ਰੇਕਫਾਸਟ ਤੇ ਲੰਚ ਕਰਵਾ ਕੇ ਅੱਧੇ ਘੰਟੇ ਘੰਟੇ ਵਾਸਤੇ ਮੈਨੂੰ ਕੰਮ ਹੈ ਥੋੜਾ ਜਿਹਾ ਫਿਰ ਮੈਂ ਚਲੀ ਜਾਗੀ ਫਿਰ ਮੈਂ ਆ ਜਾਗੀ ਘੰਟੇ ਬਾਅਦ ਸ਼ਾਮ ਨੂੰ ਮੈਂ ਆ ਕੇ ਫਿਰ ਪਹਿਲਾਂ ਤੁਹਾਡਾ ਫੰਕਸ਼ਨ ਸੰਭਾਲ ਲਵਾਂਗੀ ਹਾਂਜੀ ਹਾਂਜੀ ਹਾਂਜੀ ਨਹੀਂ ਦੀਦੀ ਮੈਂ ਸੱਤ ਵਜੇ ਤੱਕ ਆ ਜਾਵਾਂਗੀ ਸਵੇਰੇ ਹਾਂਜੀ ਛੇ ਵਜੇ ਠੀਕ ਹੈ ਜੀ

ਹਾਂਜੀ ਹਾ ਹਾਂਜੀ ਤੇ ਤੁਸੀਂ ਮੈਨੂੰ ਛੋੜ ਦਿਓਗੇ ਰਾਤ ਨੂੰ ਠੀਕ ਹੈ ਜੀ ਹਾਂਜੀ ਠੀਕ ਨਹੀਂ ਦੀਦੀ ਮੈਂ ਰਾਤ ਨੂੰ ਮੈਨੂੰ ਨੌ ਵਜੇ ਤੱਕ ਫਰੀ ਕਰ ਦੇਣਾ ਨੋ ਸਾਢੇ ਨੋ ਤੱਕ ਫਰੀ ਕਰ ਦੇਣਾ ਹਾਂਜੀ ਠੀਕ ਹੈ ਦੀਦੀ ਠੀਕ ਐ ਜੀ ਠੀਕ ਐ ਠੀਕ ਐ ਹਾਂਜੀ ਹਾਂਜੀ ਹਾਂਜੀ ਹਾਂਜੀ ਮੇਰਾ ਆਪਣਾ ਵੀ ਬੇਟਾ ਮੈਂ ਉਹਨੂੰ ਵੀ ਸਕੂਲ ਭੇਜਦੀ ਆ ਕੋਈ ਗੱਲ ਨਹੀਂ ਫਿਰ ਮੈਂ ਉਹਨਾਂ ਨੂੰ ਵੀ ਕਰ ਲਵਾਂਗੀ ਤਿਆਰ ਬ੍ਰੇਕਫਾਸਟ ਵਗੈਰਾ ਲੰਚ ਹਾਂਜੀ ਠੀਕ ਐ ਹਾਂਜੀ ਹਾਂਜੀ ਮੈਂ ਵਾਟਰ ਬੋਤਲ ਲੰਚ ਬੋਕਸ ਸਾਰਾ ਪੈਕ ਕਰ ਦਵਾਂਗੀ ਪਾ ਦਾਂਗੇ ਬੈਗ 'ਚ ਵੀ ਹਾਂਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਦੀਦੀ ਓਕੇ ਓਕੇ